ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਂਜੀ ਬਾਈ ਜੀ ਮੈਂ ਆਪਣੀ ਕੈਬ ਬੁੱਕ ਕੀਤੀ ਸੀ ਹਾਂ ਮੈਂ ਬਠਿੰਡੇ ਤੋਂ ਦਿੱਲੀ ਗਿਆ ਸੀ ਅਤੇ ਦਿੱਲੀ ਤੋਂ ਵਾਪਿਸ ਆਇਆ ਆ ਹਾਂ ਇਹ ਤੁਹਾਡਾ ਜਿਹੜੇ ਤੁਹਾਡੇ ਨਾਲ ਜਿਹੜੀ ਆਪਣੀ ਪੇਮੈਂਟ ਦੀ ਗੱਲ ਹੋਈ ਸੀ ਪੈਸਿਆਂ ਦੀ ਗੱਲ ਹੋਈ ਸੀ ਉਹ ਸੱਤ ਹਜ਼ਾਰ ਦੀ ਹੋਈ ਸੀ ਪਰ ਇਹ ਡਰਾਈਵਰ ਆ ਜਿਹੜਾ ਇਹ ਸਾਢੇ ਅੱਠ ਹਜ਼ਾਰ ਰੁਪਈਆ ਮੰਗ ਰਿਹਾ ਸਾਢੇ ਅੱਠ ਹਜ਼ਾਰ ਦੀ ਤਾਂ ਬਾਈ ਕੋਈ ਗੱਲ ਹੀ ਨਹੀਂ ਫਿਰ ਗੱਲ ਤਾਂ ਆਪਣੀ ਸਾਰੀ ਸੱਤ ਹਜ਼ਾਰ ਦੀ ਹੋਈ ਸੀ ਇਹ ਮੈਨੂੰ ਬਹੁਤ ਪਰੇਸ਼ਾਨ ਕਰ ਰਿਹਾ ਤੁਸੀਂ ਨਹੀਂ ਨਹੀਂ ਇਹ ਥੋੜ੍ਹੀ ਹੁੰਦਾ ਹੁਣ ਹਰ ਇਹ ਡਰਾਈਵਰ ਆਪਣੀ ਮਰਜ਼ੀ ਕਿਵੇਂ ਕਰਨ ਜਦੋਂ ਮੈਂ ਤੁਹਾਡੇ ਨਾਲ ਗੱਲ ਹੀ ਕਰ ਲਈ ਜਾਂ ਤੁਸੀਂ ਮੈਨੂੰ ਉਦੋਂ ਹੀ ਕਹਿੰਦੇ ਕਿ ਇਹ ਜਿਹੜਾ ਕਿਰਾਇਆ ਇਹ ਸਾਢੇ ਅੱਠ ਹਜ਼ਾਰ ਲੱਗੂਗਾ ਜਦੋਂ ਆਪਣੀ ਗੱਲ ਸੱਤ ਹਜ਼ਾਰ 'ਚ ਹੋਈ ਹੈ ਤਾਂ ਫਿਰ ਮੈਂ ਸੱਤ ਹੀ ਦੇਊਂਗਾ ਨਾ ਬਈ ਮੈਂ ਵੱਧ ਤਾਂ ਪੈਸੇ ਦੇ ਨਹੀਂ ਸਕਦਾ ਨਾ ਹੀ ਮੇਰੇ ਕੋਲ ਇੰਨੇ ਹੈ ਕੀ ਵੱਧ ਦੇਵਾਂ ਹਾਂ ਤੁਸੀਂ ਆਪਣੇ ਡਰਾਈਵਰ ਨਾਲ ਗੱਲ ਕਰ ਲਓ ਅਤੇ ਮੈਂ ਇਹਨੂੰ ਵੱਧ ਪੈਸੇ ਨਹੀਂ ਦਿੰਦਾ ਨਹੀਂ ਮੈਂ ਤਾਂ ਸੱਤ ਹਜ਼ਾਰ ਹੀ ਦੇਊਂਗਾ ਕਿਉਂਕਿ ਮੇਰੀ ਸੱਤ ਹਜ਼ਾਰ ਦੀ ਗੱਲ ਹੋਈ ਉਸ ਤੋਂ ਘੱਟ ਮੈਂ ਦੇ ਨਹੀਂ ਰਿਹਾ ਸੱਤ ਹਜ਼ਾਰ ਮੈ ਇਹਨਾਂ ਨੂੰ ਦੇ ਰਿਹਾ ਹਾਂ ਤੁਸੀਂ ਗੱਲ ਕਰ ਦਿਓ ਕੋਈ ਗੱਲ ਨਹੀਂ ਮੈਂ ਸੱਤ ਹਜ਼ਾਰ ਰੁਪਏ ਇਹ ਨੂੰ ਪੇਮੈਂਟ ਦੇ ਦਿੰਨਾ ਉਹ ਮੈਂ ਗੂਗਲ ਪੇ ਕਰ ਰਿਹਾ ਗਾ ਹਾਂ ਠੀਕ ਹੈ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ